ਜ਼ਿੰਦਗੀ 'ਚ ਮੈਂ ਦੋ ਸਬਕ ਸਿੱਖੇ ਹਨ ਪਹਿਲਾ ਕਿਸੇ ਨੂੰ ਧੋਖਾ ਨਹੀਂ ਦੇਣਾ ਦੂਜਾ ਹਮੇਸ਼ਾ ਸਭ ਨਾਲ਼ ਪਿਆਰ ਨਾਲ਼ ਗੱਲ ਕਰਨੀ ਹੈ ਪਹਿਲੀ ਵਾਰ ਜਦ ਮੈਂ ਧੋਖਾ ਦਿੱਤਾ ਸੀਗਾ ਆਪਣੇ ਯਾਰ ਮਿੱਤਰ ਨੂੰ ਅਤੇ ਉਸਦੇ ਮੈਂ ਸਾਡਾ ਅਸੀਂ ਕੁੱਤਾ ਵਿਕਵਾਇਆ ਸੀਗਾ ਅਤੇ ਮੈਂ ਉਹ ਵਿੱਚੋਂ ਤਿੰਨ ਕੁ ਹਜ਼ਾਰ ਰੁਪਇਆ ਖਾ ਲਿਆ ਸੀਗਾ ਫੇਰ ਉਸ ਤੋਂ ਬਾਅਦ ਉਸਨੂੰ ਪਤਾ ਲੱਗ ਗਿਆ ਸੀਗਾ ਵੀ ਇਸਨੇ ਤਿੰਨ ਹਜ਼ਾਰ ਰੁਪਇਆ ਖਾਇਆ ਹੈ ਫੇਰ ਸਾਡੀ ਦੋਸਤੀ 'ਚ ਫਿੱਕ ਪੈਣ ਲੱਗ ਗਈ ਸੀ ਫਿਰ ਮੈਂ ਉਸਨੂੰ ਤਿੰਨ ਹਜ਼ਾਰ ਰੁਪਈਆ ਮਾਫੀ ਮੰਗ ਕੇ ਮੈਂ ਦਿੱਤੇ ਫਿਰ ਅਸੀਂ ਆਪਣੀ ਦੋਸਤੀ ਬਚਾਈ ਪਹਿਲਾ ਸਬਕ ਇਹੀ ਮੈਂ ਸਿੱਖ ਲਿਆ ਵੀ ਅਸੀਂ ਧੋਖਾ ਨਹੀਂ ਦੇਣਾ ਕਿਸੀ ਨੂੰ ਦੂਜਾ ਸਬਕ ਮੇਰੀ ਜ਼ਿੰਦਗੀ ਦਾ ਸੀ ਵੀ ਹਮੇਸ਼ਾ ਸਭ ਨਾਲ਼ ਪਿਆਰ ਨਾਲ਼ ਬੋਲਣਾ ਹੈ ਜੋ ਕਿ ਪਹਿਲਾਂ ਮੈਂ ਐਵੇਂ ਹੀ ਬੋਲਦਾ ਰਹਿੰਦਾ ਸੀਗਾ ਲੋਕਾਂ ਨੂੰ ਓਏ ਕਿਆ ਹਾਲ ਹੈ ਓਏ ਐਂ ਆਪਣੇ ਵੱਡਿਆਂ ਨੂੰ ਵੀ ਫਿਰ ਇੱਕ ਦਿਨ ਮੈਨੂੰ ਇਕ ਅੰਕਲ ਮਿਲੇ ਸੋਹਣ ਸਿੰਘ ਉਹਨਾਂ ਦਾ ਨਾਮ ਸੀ ਅਤੇ ਉਹਨਾਂ ਨੇ ਸਾਨੂੰ ਕਿਹਾ ਵੀ ਪੁੱਤ ਐਵੇਂ ਨਹੀਂ ਬੋਲ ਉਹਨਾਂ ਨੇ ਮੈਨੂੰ ਸਮਝਾਇਆ ਆਪਣੇ ਪੁਰਾਣੇ ਟਾਈਮ ਦੀ ਗੱਲ ਦੱਸੀ ਉਹਨਾਂ ਸਮਝਾਇਆ ਕਹਿੰਦੇ ਐਵੇਂ ਨਹੀਂ ਬੋਲਣਾ ਹੈ ਕਿਸੇ ਨੂੰ ਪੁੰਨ ਦੱਸਿਆ ਫਿਰ ਉਹਨਾਂ ਨੇ ਮੈਨੂੰ ਦੂਜਾ ਜ਼ਿੰਦਗੀ ਦਾ ਸਭ ਨਾਲ਼ੋ ਬ ਸਬਕ ਦਿੱਤਾ ਜਿਸ ਵਿੱਚ ਉਹਨਾਂ ਨੇ ਦੱਸਿਆ ਵੀ ਹਮੇਸ਼ਾ ਸਭ ਨਾਲ਼ ਪਿਆਰ ਨਾਲ਼ ਬੋਲਣਾ ਹੈ ਵੱਡਿਆਂ ਛੋਟਿਆਂ ਨਾਲ਼ ਆਦਰ ਨਾਲ਼ ਤੈਨੂੰ ਵੀ ਆਦਰ ਮਿਲੂਗਾ ਜੇ ਤੁਸੀਂ ਦੂਈ ਨੂੰ ਆਦਰ ਦਿਉਂਗੇ